ਮੈਂ ਪਟਿਆਲੇ ਸ਼ਹਿਰ ਵਿੱਚ ਰਹਿੰਦੀ ਹਾਂ ਅਤੇ ਪਟਿਆਲੇ ਸ਼ਹਿਰ ਦੇ ਨਾਲ ਲੱਗਦੇ ਕਈ ਪਿੰਡ ਹਨ ਉਹਨਾਂ ਵਿੱਚੋ ਇੱਕ ਪਿੰਡ ਸੂਲਰ ਹੈ ਜਿੱਥੇ ਮੇਰੀ ਸਹੇਲੀ ਵੀ ਰਹਿੰਦੀ ਹੈ ਅਤੇ ਮਾਸੀ ਵੀ ਰਹਿੰਦੀ ਹੈ ਅਤੇ ਛੁੱਟੀਆਂ ਵਿੱਚ ਅਸੀਂ ਕਈ ਵਾਰ ਅਸੀਂ ਉੱਥੇ ਚਲੇ ਜਾਂਦੇ ਹਾਂ ਪਿੰਡ ਵਿੱਚ ਅ ਉੱਥੇ ਖੇਤ ਬਹੁਤ ਹੀ ਵਧੀਆ ਲੱਗਦੇ ਹਨ ਉੱਥੇ ਕਈ ਗੁਰਦੁਆਰੇ ਮੰਦਿਰ ਹਨ ਜਿੱਥੇ ਜਾ ਕੇ ਮੱਥਾ ਟੇਕ ਕੇ ਬਹੁਤ ਹੀ ਸਕੂਨ ਮਿਲਦਾ ਹੈ ਅਤੇ ਬਹੁਤ ਹੀ ਵਧੀਆ ਲੱਗਦਾ ਹੈ ਅਸੀਂ ਉੱਥੇ ਹਰ ਛੁੱਟੀਆਂ ਵਿੱਚ ਜਾਂਦੇ ਹਾਂ ਅਤੇ ਓ ਉਹਨਾਂ ਨਾਲ ਮਿਲ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਪਿੰਡ ਬਹੁਤ ਹੀ ਸੋਹਣੇ ਹੁੰਦੇ ਹਨ ਅਸੀਂ ਉੱਥੇ ਘੁੰਮਦੇੇ ਹਾਂ ਜਾਂ ਕੁਛ ਵੀ ਕੋਈ ਵੀ ਖੇਡ ਖੇਡ ਲੈਂਦੇ ਹਾਂ ਅਤੇ ਉੱਥੇ ਘੁੰਮ ਕੇ ਅਤੇ ਓ ਪਿੰਡ ਦੇ ਜਿੰਨੇ ਵੀ ਘਰ ਹਨ ਬ ਦੇਖ ਕੇ ਬਹੁਤ ਹੀ ਅੱਛਾ ਲੱਗਦਾ ਹੈ ਅਤੇ ਉੱਥੇ ਘੁੰਮ ਕੇ ਬਹੁਤ ਹੀ ਸਾਨੂੰ ਇਹ ਸਭ ਦੇਖ ਕੇ ਬਹੁਤ ਹੀ ਵਧੀਆ ਲੱਗਦਾ